ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਕੁਛ ਵੀ ਲਿਖਣਾ ਬੋਲਣਾ ਸਾਡੇ ਲਈ ਵਰਜਿਤ ਹੋਵੇ ਕਿਉਂਕਿ ਸਾਡੇ ਭਾਰਤ ਦੇ ਸੰਵਿਧਾਨ ਨੇ ਸਾਨੂੰ ਇਹ ਆਜ਼ਾਦੀ ਦਿੱਤੀ ਹੈ ਕਿ ਜਿਸ ਲਈ ਆਪਾਂ ਪੰਜਾਬ ਜਾਂ ਭਾਰਤ ਦੇ ਵਿੱਚ ਕੁਛ ਵੀ ਲਿਖ ਬੋਲ ਸਕਦੇ ਹਾਂ ਕੁਛ ਵੀ ਇੱਦਾਂ ਦਾ ਚੀਜ਼ ਨਹੀਂ ਹੈ ਜੋ ਸਾਡੇ ਲਈ ਵਰਜਿਤ ਹੋਵੇ ਜਾਂ ਜਿਸ ਉੱਪਰ ਆਪਾਂ ਡਿਬੇਟ ਜਾਂ ਲਿਖ ਨਾ ਸਕੀਏ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਸਾਡੇ ਇਹ ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦਾ ਹੈ ਕਿ ਆਪਾਂ ਫੁੱਲ ਪੂਰੀ ਆਜ਼ਾਦੀ ਦੇ ਨਾਲ ਕੁਛ ਵੀ ਲਿਖ ਬੋਲ ਸਕਦੇ ਹਾਂ ਅਤੇ ਸਰਕਾਰ ਵੀ ਸਾਨੂੰ ਇਸ ਲਈ ਨਹੀਂ ਰੋਕ ਸਕਦੀ ਜਾਂ ਕੋਈ ਵੀ ਵਿਸ਼ਾ ਉਹ ਵਰਜਿਤ ਨਹੀਂ ਕਰ ਸਕਦੀ ਜਿਸ ਉੱਪਰ ਆਪਾਂ ਬੋਲ ਨਾ ਸਕੀਏ ਇਸ ਲਈ ਫ਼ਿਲਹਾਲ ਤਾਂ ਹਾਲੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਭਾਰਤ ਦੇ ਵਿੱਚ ਕੋਈ ਵੀ ਅਜਿਹਾ ਵਿਸ਼ਾ ਹੈ ਜੋ ਕਿ ਸਾਡੇ ਅਕੋਰਡਿੰਗ ਵਰਜਿਤ ਹੋਵੇ